ਪੁਰਾਣੇ ਸਮਿਆਂ ਵਿੱਚ ਅਸੀਂ ਘਰ ਰੱਖੇ ਹੋਏ ਪਸ਼ੂਆਂ ਨੂੰ ਖੇਤਾਂ ਵਿੱਚ ਚੁਰਾਉਣ ਲਈ ਲੈ ਜਾਂਦੇ ਸੀ ਉਸ ਤੋਂ ਪਹਿਲਾਂ ਬੜਾ ਲੰਬਾ ਸਮਾਂ ਪਹਿਲਾਂ ਪਿੰਡਾਂ ਵਿੱਚ ਵੱਡੀਆਂ ਚਰਗਾਹਾਂ ਵੱਖਰੀਆਂ ਰੱਖੀਆਂ ਜਾਂਦੀਆਂ ਸੀ ਉਹਨਾਂ ਨੂੰ ਸਾਡੇ ਸਮਾਜ ਦੇ ਵਿੱਚ ਬੀੜ ਬੋਲਿਆ ਜਾਂਦਾ ਸੀ ਉਹ ਬੀੜ ਪਸ਼ੂਆਂ ਲਈ ਰਾਖਵੇਂ ਹੁੰਦੇ ਸਨ ਹਰ ਕੋਈ ਆਪਣੇ ਪਸ਼ੂ ਉੱਥੇ ਲਿਜਾ ਕੇ ਖੁੱਲੇ ਛੱਡਦਾ ਸੀ ਇਸ ਤਰ੍ਹਾਂ ਕਰਨ ਨਾਲ ਪਸ਼ੂਆਂ ਵਿੱਚ ਇੱਕ ਤਾਂ ਇਮਿਊਨਿਟੀ ਜ਼ਿਆਦਾ ਪੈਦਾ ਹੁੰਦੀ ਹੈ ਦੂਸਰਾ ਉਹਨਾਂ ਦੀ ਦੁੱਧ ਦੇਣ ਦੀ ਸਮਰੱਥਾ ਵੱਧ ਜਾਂਦੀ ਹੈ ਉਹ ਆਪਣਾ ਖੇਲ ਕੁੱਦ ਵੀ ਕਰ ਲੈਂਦੇ ਪਰ ਸਮਾਂ ਬਦਲਣ ਦੇ ਨਾਲ ਨਾਲ ਇਹ ਸਭ ਘਟ ਗਿਆ ਬੀੜ ਵੀ ਲੋਕਾਂ ਨੇ ਹਿੱਸੇ ਮੁਤਾਬਿਕ ਵੰਡ ਲਏ ਅਤੇ ਚਰਾਗਾਹਾਂ ਖਤਮ ਹੋ ਗਈਆਂ ਰਹਿੰਦੀ ਕਸਰ ਪਲਾਸਟਿਕ ਅਤੇ ਹੋਰ ਪ੍ਰਦੂਸ਼ਣ ਨੇ ਕੱਢ ਦਿੱਤੀ ਜੋ ਪਿੰਡਾਂ ਦੇ ਛੱਪੜਾਂ ਵਿੱਚ ਸੜਕਾਂ ਦੇ ਕਿਨਾਰਿਆਂ 'ਤੇ ਜਿੱਥੇ ਕਿਤੇ ਪਸ਼ੂ ਚਰ ਸਕਦੇ ਸੀ ਜਿੱਥੇ ਛੱਪੜਾਂ ਵਿੱਚ ਆਰਾਮ ਕਰ ਸਕਦੇ ਸੀ ਉਸ ਨੂੰ ਪਲਾਸਟਿਕ ਅਤੇ ਗੰਦੇ ਪਾਣੀ ਨੇ ਇੰਨਾਂ ਗੰਦਾ ਕਰਤਾ ਕਿ ਅਸੀਂ ਉਹਦੇ ਕੋਲ ਵੀ ਨਹੀਂ ਰੁਕ ਸਕਦੇ ਅਤੇ ਸਾਡੇ ਵਰਗਾ ਸਰੀਰ ਹੀ ਪਸ਼ੂ ਦਾ ਹੁੰਦਾ ਹੈ ਉਹ ਵੀ ਉੱਥੇ ਨਹੀਂ ਰੁਕ ਸਕਦੇ ਜਾਂ ਫਿਰ ਅਸੀਂ ਰੋਕਣਾ ਨਹੀਂ ਚਾਹੁੰਦੇ ਇਸ ਕਰਕੇ ਇਹ ਕਮੀ ਪਸ਼ੂ ਧਨ ਲਈ ਬਹੁਤ ਮਾੜੀ ਹੈ